ਪੰਜਾਬ ਇੱਕ ਐਹੋ ਜਿਹਾ ਰਾਜਯ ਹੈ ਜਿੱਥੇ ਕਿ ਉਦਯੋਗਿਕ ਸ਼ੇਤਰ ਬਹੁਤ ਜ਼ਿਆਦਾ ਅੱਗੇ ਵੱਧ ਰਿਹਾ ਹੈ ਇਸ ਨੂੰ ਯਕੀਨੀ ਬਣਾਉਣ 'ਚ ਸਰਕਾਰ ਵੱਲੋਂ ਬਹੁਤ ਕਦਮ ਉਠਾਏ ਜਾਂਦੇ ਹਨ ਹੁਣ ਤਾਂ ਹਰ ਸਰਕਾਰੀ ਦਫਤਰ ਹੋਵੇ ਜਾਂ ਪ੍ਰਾਈਵੇਟ ਦਫਤਰ ਹੋਵੇ ਓਥੇ ਲੋਕਾਂ ਦੀ ਜਿਹੜੀ ਅਟੈਂਡਸ ਹੈ ਉਹ ਵੀ ਹੁਣ ਬਾਇਓਮੈਟ੍ਰਿਕ ਸ਼ੁਰੂ ਹੋ ਚੁੱਕੀ ਹੈ ਜਿਹੜਾ ਕਿ ਪਹਿਲਾਂ ਲੋਕੀ ਰਜਿਸਟਰਾਂ 'ਚ ਹਾਜ਼ਰੀਆਂ ਲਾਂਦੇ ਸੀ ਹੁਣ ਉਹ ਸਿਰਫ਼ ਆਪਣਾ ਫੇਸ ਇਮਪ੍ਰੈਸ਼ਨ ਦੇ ਕੇ ਹੀ ਆਪਣੀ ਹਾਜ਼ਰੀ ਨੂੰ ਯਕੀਨੀ ਬਣਾਉਂਦੇ ਹਨ ਹੁਣ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਅਕਾਊਂਟਸ ਵਿੱਚ ਵੀ ਮੈਨੁਅਲੀ ਕੰਮ ਪਹਿਲਾਂ ਹੁੰਦਾ ਸੀਗਾ ਹੁਣ ਇਸ ਚੀਜ਼ ਨੂੰ ਵੀ ਪਿੱਛੇ ਕਰ ਦਿੱਤਾ ਗਿਆ ਹੈ ਅਤੇ ਅਕਾਊਂਟ ਦਾ ਜਿਹੜਾ ਕੰਮ ਸਾਰਾ ਟੈਲੀ ਰਾਹੀਂ ਹੁੰਦਾ ਹੈ ਜਿਸ ਕਰਕੇ ਕੀ ਘੰਟਿਆਂ ਦੋ ਘੰਟਿਆਂ ਦਾ ਕੰਮ ਮਿੰਟਾਂ ਸਕਿੰਟਾਂ 'ਚ ਹੋ ਜਾਂਦਾ ਹੈ ਹੁਣ ਤਾਂ ਪੰਜਾਬ 'ਚ ਜਾਂ ਇੰਡ ਭਾਰਤ 'ਚ ਇਹੋ ਜਿਹੀਆਂ ਫੈਕਟਰੀਆਂ ਹਨ ਜਿੱਥੇ ਕਿ ਮਸ਼ੀਨਾਂ ਇੰਨੀਆਂ ਤਕਨੀਕੀ ਹੋਗੀਆਂ ਹਨ ਕਿ ਜਿਹੜੀਆਂ ਅੱਖਾਂ ਵੇਖਦੇ ਹੀ ਸਾਰਾ ਕੰਮ ਖਤਮ ਕਰ ਦਿੰਦੀਆਂ ਹਨ ਇਸ ਕਰਕੇ ਇਨ੍ਹਾਂ ਦੀ ਵਰਤੋਂ ਕਰਕੇ ਮੈਨਪਾਵਰ ਤਾਂ ਘੱਟ ਹੋਈ ਹੈ ਪਰ ਜਿਹੜਾ ਕੰਮ ਅੱਠ ਦਸ ਦਿਨਾਂ 'ਚ ਹੁੰਦਾ ਸੀ ਉਹ ਹੁਣ ਦੋ ਚਾਰ ਦਿਨਾਂ 'ਚ ਹੀ ਹੋ ਜਾਂਦਾ ਹੈ